ਹੈਲੋ ਹਾਂਜੀ ਹਾਂਜੀ ਸਰ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਸਰ ਹਾਂਜੀ ਹਾਂਜੀ ਸਰ ਸੰਧੂ ਟਰੈਵਲ ਤੋਂ ਹੀ ਗੱਲ ਕਰ ਰਹੇ ਹਾਂ ਜੀ ਹਾਂਜੀ ਹਾਂਜੀ ਸਰ ਮਿਲ ਜੂਗਾ ਸਰ ਸਰ ਇਹ ਪੂਰਾ ਜਿਹੜਾ ਹੈਗਾ ਟੂਰ ਦਾ ਪੈਕਜ ਹੈ ਇਹ ਦਸ ਹਜ਼ਾਰ ਦਾ ਹੈਗਾ ਗਾ ਜੀ ਅਤੇ ਇਸ ਦੇ ਵਿੱਚ ਤੁਹਾਨੂੰ ਰਹਿਣ ਦਾ ਯਾਨੀ ਕਿ ਉੱਥੇ ਘੁੰਮਣ ਫਿਰਨ ਦਾ ਟੈਕਸੀ ਦਾ ਖਰਚਾ ਹੋਟਲ ਦਾ ਖਰਚਾ ਜਿਹੜਾ ਤੁਹਾਨੂੰ ਅਸੀਂ ਉਹ ਕਰਾਂਗੇ ਅਤੇ ਇੱਕ ਟਾਈਮ ਦੀ ਰੋਟੀ ਦਾ ਖਰਚਾ ਹਾਂਜੀ ਜੀ ਇਹ ਸਰ ਤਿੰਨ ਦਿਨ ਦਾ ਹੋ ਗਿਆ ਜੀ ਹਾਂਜੀ ਹਾਂਜੀ ਹਾਂਜੀ ਸਰ ਜੀ ਸਰ ਉਹ ਤੁਹਾਨੂੰ ਅਸੀਂ ਫੋਰ ਸਟਾਰ ਉਹ ਕਰਵਾਵਾਂਗੇ ਵਧੀਆ ਅ ਹਾਂਜੀ ਫੋਰ ਸਟਾਰ ਹੋਟਲ ਹਰੇਕ ਤਰ੍ਹਾਂ ਦੀ ਫੈਸਿਲਿਟੀ ਉਹਦੇ ਵਿੱਚ ਤੁਹਾਨੂੰ ਮਿਲੇਗੀ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਸਰ ਅਤੇ ਤੁਹਾਨੂੰ ਜਿਹੜੀ ਕਿ ਹਾਫ ਪੇਮੈਂਟ ਤੁਹਾਨੂੰ ਪਹਿਲਾਂ ਤੁਹਾਨੂੰ ਕਰਨੀ ਪਏਗੀ ਅਤੇ ਹਾਫ ਉੱਥੇ ਪਹੁੰਚ ਕੇ ਤੁਸੀਂ ਕਰ ਸਕਦੇ ਹੈ ਨਾ ਜੀ ਅਤੇ ਫੂਡ ਸਰ ਵੇਖੋ ਜੀ ਦੋ ਨਹੀਂ ਲੰਚ ਅਤੇ ਡਿਨਰ ਸਰ ਬਾਕੀ ਜੇ ਤੁਸੀਂ ਦੁਪਹਿਰ ਦਾ ਉਹ ਕਰਨਾ ਤਾਂ ਉਹ ਤੁਹਾਨੂੰ ਆਪਣਾ ਉਹ ਔਡਰ ਕਰਨਾ ਪਏਗਾ ਹਾਂਜੀ ਸਰ ਉਹ ਜੋ ਤੁਸੀਂ ਵੇਖੋ ਜ਼ਿਆਦਾ ਤਾਂ ਅਸੀਂ ਨੋਨ ਵੈੱਜ ਹੀ ਉਹ ਕਰਾਂਗੇ ਅਤੇ ਬਾਕੀ ਕਈ ਵਾਰੀ ਨੋਨ ਵੈੱਜ ਦਾ ਨਹੀਂ ਕੋਈ ਹੁੰਦਾ ਵੀ ਤੁਸੀਂ ਦੱਸ ਦਿਓ ਵੀ ਕਿੱਦਾਂ ਦਾ ਉਸ ਹਿਸਾਬ ਨਾਲ ਥੋੜ੍ਹਾ ਬਹੁਤਾ ਖਰਚਾ ਉੱਪਰ ਉੱਤੇ ਹੋ ਸਕਦਾ ਹੈਗਾ ਕੋਈ ਜ਼ਿਆਦਾ ਨਹੀਂ ਗਾ ਠੀਕ ਹੈ ਸਰ ਹਾਂ ਹਾਂਜੀ ਸਰ ਜੇ ਕੋਈ ਤੁਸੀਂ ਹੈਗਾ ਤਾਂ ਉਸਦਾ ਤੁਹਾਨੂੰ ਜਿਹੜਾ ਵੀ ਕੋਈ ਚਾਰਜਸ ਹੋਏਗਾ ਉਹ ਤੁਸੀਂ ਸਾਨੂੰ ਦੇ ਦਿਓ ਜਾਂ ਉਹਨਾਂ ਨੂੰ ਉੱਥੇ ਹੀ ਕਰ ਦਿਓ ਉਹ ਤੁਹਾਨੂੰ ਅਸੀਂ ਕਰ ਦਾਂਗੇ ਸਰ ਉੱਥੇ

ਜੀ ਸਰ

ਜੀ ਸਰ ਓਕੇ ਸਰ ਓਕੇ ਸਰ ਓਕੇ ਬਾਏ ਸਰ